ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੇਟੇ ਪੰਜਾਬ ਦੇ ਨਾ ਤਿੰਨ ਬੋਰਡਰ ਹੈਗੇ ਨੇ ਠੀਕ ਹੈ ਇੱਕ ਤਾਂ ਜਿਹੜਾ ਹਿਮਾਚਲ ਵਾਲੀ ਸਾਈਡ ਦੇ ਹੈਗਾ ਜਿਹੜਾ ਜੰਮੂ ਕਸ਼ਮੀਰ ਨੂੰ ਜਿਹੜਾ ਆਪਣਾ ਕੰਨੈਕਟ ਕਰਦਾ ਹੈਗਾ ਜਿਹਨੂੰ ਆਪਾਂ ਕਹਿ ਦਿੰਦੇ ਆਹਾਂ ਜਿਹੜੇ ਨੋਰਥ ਸਾਈਡ 'ਤੇ ਹੈਗਾ ਉਹ ਜਿਹਨੂੰ ਆਪਾਂ ਕਹਿੰਦੇ ਆ ਉੱਤਰ ਦਿਸ਼ਾ ਦੇ ਵਿੱਚ ਇੱਕ ਬੋਡਰ ਲੱਗਦਾ ਹਿਮਾਚਲ ਪ੍ਰਦੇਸ਼ ਦੇ ਨਾਲ ਪੰਜਾਬ ਦਾ ਹਾਂ ਥੋੜ੍ਹਾ ਜਿਹਾ ਤੁਸੀਂ ਇਹਨੂੰ ਵੱਡਾ ਕਰਕੇ ਲਿਖ ਦਿਓ ਅਤੇ ਦੱਸ ਦਿਓ ਕਿ ਮਤਲਬ ਪੰਜਾਬ ਦੇ ਕਿੰਨੇ ਉਹ ਨਾਲ ਰਹਿਣ ਵਾਲੇ ਹੈਗੇ ਨੇ ਉਹ ਕਿਸੇ ਦਾ ਜਿੱਦਾਂ ਉਹ ਹੈਗੇ ਨੇ ਉਹਨਾਂ ਨੂੰ ਹਾਂਜੀ ਹਾਂਜੀ ਉਹ ਤਾਂ ਹੈ ਜੀ ਅਤੇ ਅਤੇ ਫਿਰ ਇੱਦਾਂ ਕਰਕੇ ਹੈ ਫਿਰ ਜਿਹੜਾ ਦੂਜਾ ਹੈਗਾ ਹੈ ਫਿਰ ਇੱਕ ਹਰਿਆਣੇ ਦਾ ਹੈਗਾ ਉਹ ਸਾ ਸਾਊਦਰਨ ਸਾ ਸਾਊਥ ਦਾ ਲੱਗਦਾ ਉਹਦਾ ਬੋਡਰ ਅਤੇ ਇਹ ਆਪਣਾ ਦੂਜਾ ਬੋਡਰ ਹੋ ਜਾਂਦਾ ਹੈਗਾ ਅਤੇ ਇਸਤੋਂ ਬਾਅਦ ਇਹਦੇ ਵਿਚ ਹਰਿਆਣਾ ਦੇ ਵਿੱਚ ਤੁਸੀਂ ਇਹਦੀ ਵੱਖ ਵੱਖ ਜਗਾਵਾਂ ਬਾਰੇ ਦੱਸ ਸਕਦੇ ਹੈਗੇ ਓ ਜੰਮੂ ਕਸ਼ਮੀਰ ਦੀ ਵੱਖ ਵੱਖ ਜਗਾਵਾਂ ਬਾਰੇ ਦੱਸ ਸਕਦੇ ਹੋ ਅਤੇ ਕਿਹੜੇ ਕਿਹੜੇ ਰੂਟ ਹੈਗੇ ਆ ਆਪਣੀ ਨਦੀਆਂ ਬਾਰੇ ਤੁਸੀਂ ਇਹਦੇ ਵਿੱਚ ਥੋੜ੍ਹਾ ਦੱਸ ਸਕਦੇ ਹੈਗੇ ਹੋ ਉਹਦੇ ਵਿੱਚ ਕੀ ਹੈਗਾ ਸਾਨੂੰ ਜਿਹੜਾ ਪੇਪਰ ਵਿੱਚ ਕੁਸ਼ਚਨ ਆਏਗਾ ਜਿਸ ਹਿਸਾਬ ਨਾਲ ਤੁਹਾਨੂੰ ਕੁਸ਼ਚਨ ਆਏਗਾ ਫਿਰ ਤੁਸੀਂ ਉਸ ਹਿਸਾਬ ਨਾਲ ਉਸ ਕੁਸ਼ਚਨ ਨੂੰ ਉਹਦੇ ਵਿੱਚ ਲਿਖ ਹਾਂਜੀ ਹਾਂਜੀ ਅਤੇ ਜਿਹੜਾ ਤੀਜਾ ਹੈਗਾ ਉਹ ਹੈਗਾ ਅ ਤੁਹਾਡਾ ਰਾਜਸਥਾਨ ਵਾਲਾ ਜਿਹੜਾ ਕਿ ਲੱਗਦਾ ਤੁਹਾਡਾ ਪਾਕਿਸਤਾਨ ਦੇ ਨਾਲ ਅੱਗੇ ਜਾ ਕੇ ਆਉਂਦਾ ਹੈ ਉਹਨੂੰ ਸਾਊਥ ਵੈਸਟ ਵਾਲੀ ਸਾਈਡ 'ਤੇ ਪੈਂਦਾ ਹੈਗਾ ਉਹ ਵਾਲਾ ਅਤੇ ਆਹ ਤਿੰਨ ਹੈਗੇ ਨੇ ਆਪਣਾ ਕੀ ਕਹਿੰਦੇ ਨੇ ਬੋਡਰ ਇੱਕ ਜੰਮੂ ਕਸ਼ਮੀਰ ਜਿਹੜਾ ਹਿਮਾਚਲ ਦੀ ਸਾਈਡ 'ਤੇ ਲੱਗਦਾ ਇੱਕ ਹਰਿਆਣਾ ਹੈ ਨਾ ਅਤੇ ਇੱਕ ਰਾਜਸਥਾਨ ਦਾ ਹੈਗਾ ਅਤੇ ਇਹ ਚੀਜ਼ਾਂ ਹੁਣ ਤੁਸੀਂ ਮੈਨੂੰ ਦੱਸੋ ਮੈ ਜੋ ਤੁਹਾਨੂੰ ਸਮਝਾਇਆ ਤੁਹਾਨੂੰ ਕੀ ਸਮਝ ਆਇਆ ਹੈਗਾ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਤੇ ਮੈਨੂੰ ਦੱਸੋ ਨਾ ਤੁਸੀਂ ਇੱਕ ਵਾਰ ਕਿਹੜੇ ਕਿਹੜੇ ਬਾਰਡਰ ਹੈਗੇ ਨੇ ਤਿੰਨ ਮੈਨੂੰ ਪਤਾ ਲੱਗੇ ਤੁਹਾਨੂੰ ਸਮਝ ਵੀ ਆਇਆ ਕਿ ਨਹੀਂ ਆਇਆ ਹੈਗਾ ਨਹੀਂ ਤੁਸੀਂ ਦੱਸੋ ਨਾ ਮੈਂ ਸੁਣਨਾ ਚਾਹੁੰਦਾ ਹੈਗਾ ਮੈਨੂੰ ਪਤਾ ਆਪਣੇ ਸਟੂਡੈਂਟਾਂ ਦਾ ਉਹ ਸੁਣਦੇ ਤਾਂ ਸਭ ਕੁਝ ਹੈ ਬਟ ਉਹਨਾਂ ਨੂੰ ਯਾਦ ਕੁਝ ਨਹੀਂ ਰਹਿੰਦਾ ਹੈਗਾ ਨਹੀਂ ਹਰਿਆਣਾ ਨੂੰ ਉਹ ਤਾਂ ਠੀਕ ਹੈ ਹਰਿਆਣਾ ਮਤਲਬ ਜਿਹੜਾ ਬਾਰਡਰ ਹੈਗਾ ਵਾ ਉਹਦੇ ਨਾਲ ਕਿਹਦੇ ਨਾਲ ਕਨੈਕਟ ਹੁੰਦਾ ਵਾ ਮਤਲਵ ਹਰਿਆਣਾ ਹੋ ਗਿਆ ਰਾਜਸਥਾਨ ਦਾ ਬਾਰਡਰ ਕਿਹਦੇ ਨਾਲ ਕਨੈਕਟ ਹੁੰਦਾ ਅੱਗੇ ਜਾ ਕੇ ਹਾਂ ਉਹ ਹਾਂਜੀ ਹਾਂਜੀ ਠੀਕ ਹੈ ਚਲੋ ਠੀਕ ਠੀਕ ਚਲੋ ਹੁਣ ਦੇਖਦੇ ਹਾਂ ਮੈਂ ਪੇਪਰ ਤੁਹਾਡਾ ਬਿਲਕੁਲ ਧਿਆਨ ਨਾਲ ਚੈੱਕ ਕਰਾਂਗਾ ਫਿਰ ਦੇਖਦੇ ਤੁਸੀਂ ਠੀਕ ਲਿਖ ਕੇ ਆਏ ਹੋ ਕਿ ਨਹੀਂ ਲਿਖ ਕੇ ਆਏ ਠੀਕ ਓਕੇ ਜੀ